ਛੱਬੀ ਜਨਵਰੀ ਦੋ ਹਜ਼ਾਰ ਸੋਲਾਂ ਗਿਆਰਾਂ ਫਰਵਰੀ ਦੋ ਹਜ਼ਾਰ ਅਠਾਰਾਂ ਤੇਰਾਂ ਮਾਰਚ ਦੋ ਹਜ਼ਾਰ ਉੱਨੀ ਸਤਾਈ ਅਗਸਤ ਦੋ ਹਜ਼ਾਰ ਵੀਹ ਤੀਹ ਦਸੰਬਰ ਦੋ ਹਜ਼ਾਰ ਬਾਈ